ਭੰਗੜਾ ਪੰਜਾਬ ਦਾ ਇੱਕ ਫੋਕ ਡਾਂਸ ਹੈ ਇਸ ਨੇ ਪੰਜਾਬ ਦੀ ਦੁਨੀਆਂ ਵਿੱਚ ਚੜ੍ਹਤ ਬਣਾਈ ਹੈ ਭੰਗੜੇ ਵਿੱਚ ਆਮ ਤੌਰ 'ਤੇ ਪਹਿਰਾਵਾ ਤੁਰਲੇ ਵਾਲੀ ਪੱਗ ਜਾਕਟ ਚਾਦਰਾ ਕੁੜਤਾ ਜੁੱਤੀ ਕੈਂਠਾ ਕਮਰਬੰਦ ਪੱਗ 'ਤੇ ਗੋਟਾ ਲੱਗਿਆ ਹੁੰਦਾ ਹੈ ਜਿਹੜੇ ਭੰਗੜਾ ਨੌਜਵਾਨ ਪਾਉਂਦੇ ਹਨ ਇਸ ਪਹਿਰਾਵੇ ਵਿੱਚ ਬਹੁਤ ਹੀ ਸੁੰਦਰ ਅਤੇ ਸੋਹਣੇ ਅਤੇ ਆਕਰਸ਼ਿਤ ਲੱਗਦੇ ਹਨ ਇਹ ਪੌਸ਼ਾਕ ਖੁੱਲ੍ਹੀ ਡੁੱਲ੍ਹੀ ਹੋਣ ਦੇ ਨਾਲ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਆਮ ਕਰਕੇ ਇਹ ਚਾਦਰਾ ਜੋ ਖੁੱਲ੍ਹਾ ਹੁੰਦਾ ਹੈ ਉਸ ਵਿੱਚ ਭੰਗੜਾ ਪਾਉਣ ਵਾਲੇ ਆ ਮੁੰਡਿਆਂ ਦਾ ਜੋ ਕੋਈ ਵੀ ਸਟੈਪ ਕਰਨਾ ਹੁੰਦਾ ਹੈ ਉਸ ਵਿੱਚ ਕਰਨਾ ਸੌਖਾ ਹੋ ਜਾਂਦਾ ਹੈ ਕਈ ਵਾਰ ਔਖੇ ਸਟੈਪ ਵੀ ਚੰਗੀ ਤਰ੍ਹਾਂ ਕੀਤੇ ਜਾ ਸਕਦੇ ਹਨ ਅਤੇ ਕਈ ਥਾਂ 'ਤੇ ਆਮ ਤੌਰ 'ਤੇ ਪੌਸ਼ਾਕ ਦੇ ਵਿੱਚ ਚਿੱਟਾ ਕੁੜਤਾ ਵੀ ਪਾਇਆ ਜਾਂਦਾ ਹੈ ਕਈ ਕਈ ਵਾਰ ਇਹ ਰੰਗ ਬਿਰੰਗੇ ਕੁੜਤੇ ਚਾਦਰੇ ਵੀ ਪਾਏ ਜਾਂਦੇ ਹਨ ਤਾਂ ਕਿ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ ਇਹ ਪੌਸ਼ਾਕ ਪੰਜਾਬੀਆਂ ਦੀ ਮਨ ਭਾਉਂਦੀਆਂ ਪੌਸ਼ਾਕਾਂ ਵਿੱਚੋਂ ਇੱਕ ਹੈ ਆਮ ਤੌਰ 'ਤੇ ਭੰਗੜਾ ਕਿਸੇ ਹੋਰ ਪੌਸ਼ਾਕ ਪਾ ਕੇ ਵੀ ਕੀਤਾ ਜਾਂਦਾ ਹੈ ਪਰ ਉਹ ਓਨਾਂ ਅਕਰਸਤ ਨਹੀਂ ਕਰਦਾ ਜਿੰਨਾ ਕਿ ਕੁੜਤਾ ਪਜਾਮਾ ਕਰਦਾ ਹੈ ਦੁਨੀਆਂ ਵਿੱਚ ਇਹ ਪਹਿਚਾਣ ਕੁੜਤਾ ਪਜਾਮਾ ਨਾਲ ਨਹੀਂ ਹੁੰਦੀ ਜਿੰਨੀ ਕਿ ਆਪਣੇ ਚਾਦਰੇ ਨਾਲ ਹੋਈ ਹੈ ਇਸ ਕਰਕੇ ਕੁੜਤਾ ਚਾਦਰਾ ਜੋ ਪੰਜਾਬੀਆਂ ਦਾ ਪੁਰਾਣਾ ਪਹਿਰਾਵਾ ਹੈ ਭੰਗੜੇ ਵਿੱਚ ਵੀ ਉਸ ਪਹਿਰਾਵੇ ਨੂੰ ਸ਼ੋ ਕਰਦਾ ਹੈ ਆਮ ਤੌਰ 'ਤੇ ਇਹ ਆਕਰਸ਼ਿਤ ਹਰ ਇੱਕ ਨੂੰ ਕਰਦਾ ਹੈ ਅਤੇ ਆਪਣੇ ਵੱਲ ਖਿੱਚਦਾ ਹੈ